ਹੈਲੋ ਹਾਂਜੀ ਮੈਮ ਹਾਂਜੀ ਕੋਈ ਗੱਲ ਨਹੀਂ ਮੈਮ ਅਸੀਂ ਇੱਧਰ ਧਿਆਨ ਦੇ ਰਹੇ ਹਾਂ ਜੀ ਅਸੀਂ ਵਾਰਡ ਨੰਬਰ ਪੰਜ ਕਿਹਾ ਤੁਸੀਂ ਅਸੀਂ ਪਹਿਲਾਂ ਵਾਰਡ ਨੰਬਰ ਚਾਰ ਦਾ ਕੰਮ ਕਰਵਾ ਰਹੇ ਹਾਂ ਅਸੀਂ ਤੁਹਾਡੇ ਵਾਰਡ ਨੰਬਰ 'ਤੇ ਵੀ ਨਿਗ੍ਹਾ ਮਾਰਾਂਗੇ ਅਤੇ ਤੁਹਾਡੀ ਜੋ ਵੀ ਸਮੱਸਿਆਵਾਂ ਨੇ ਸਾਨੂੰ ਦੱਸ ਦਿਓ ਅਸੀਂ ਤੁਹਾਡੇ ਮਤਲਬ ਕੰਮ ਸ਼ੁਰੂ ਕਰਵਾਵਾਂਗੇ ਹੁਣ ਅਸੀਂ ਵਾਰਡ ਨੰਬਰ ਚਾਰ ਦਾ ਕੰਮ ਕਰਵਾ ਰਹੇ ਸੀ ਇਸ ਤੋਂ ਬਾਅਦ ਤੁਹਾਡੇ ਵਾਰਡ ਦਾ ਹੀ ਕੰਮ ਸ਼ੁਰੂ ਕਰਵਾਉਣਾ ਗਾ ਕੀ ਦਿੱਕਤ ਆ ਰਹੀ ਆ ਮੈਮ ਹਾਂਜੀ ਅੱਛਾ ਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਟੈਂਸ਼ਨ ਨਾ ਲਓ ਆਪਾਂ ਸਾਰੇ ਕੰਮ ਕਰਵਾਵਾਂਗੇ ਸਾਰੀਆਂ ਨਾਲੀਆਂ ਸੜਕਾਂ ਪੱਕੀਆਂ ਕਰਵਾਵਾਂਗੇ ਜੀ ਹਾਂਜੀ ਹੋਰ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਇੱਧਰੋਂ ਕੰਮ ਕਰਵਾ ਦਈਏ ਇਸ ਤੋਂ ਬਾਅਦ ਤੁਹਾਡੇ ਵਾਰਡ ਵਿੱਚ ਆ ਰਹੇ ਹਾਂ ਅਸੀਂ ਅਤੇ ਸਾਰਾ ਕੰਮ ਤੁਹਾਡੀਆਂ ਸੜਕਾਂ ਪੱਕੀਆਂ ਕਰਵਾ ਕੇ ਜਾਵਾਂਗੇ ਨਾਲੀਆਂ ਸਹੀ ਕਰਵਾ ਜਾਂਗੇ ਜੀ ਸਾਰਾ ਕੰਮ ਕਰਵਾ ਦਾਂਗੇ ਹਾਂਜੀ ਬਿਜਲੀ ਦਾ ਵੀ ਜ਼ਰੂਰ ਕਰਾਂਗੇ ਜੀ ਪ੍ਰਬੰਧ ਕਿੱਦਾਂ ਟਾਈਮ 'ਤੇ ਆਉਂਦੀ ਨਹੀਂ ਲਾਈਟ ਕਿੱਦਾਂ ਅੱਛਾ ਜੀ ਅੱਛਾ ਕੋਈ ਗੱਲ ਨਹੀਂ ਜੀ ਤੁਸੀਂ ਟੈਂਸ਼ਨ ਨਾ ਲਓ ਆਪਾਂ ਸਾਰੇ ਕੰਮ ਕਰਵਾਵਾਂਗੇ ਅਸੀਂ ਤੁਹਾਡੇ ਵਾਰਡ ਵੱਲ ਵੀ ਨਿਗ੍ਹਾ ਮਾਰਦੇ ਹਾਂ ਸਾਡੇ ਹੈਗੀਆਂ ਨੇ ਸਾਡੇ ਸਿਰ 'ਤੇ ਨੇਗੀਆਂ ਗੱਲਾਂ ਤੁਹਾਡੀਆਂ ਵੀ ਕੋਈ ਗੱਲ ਨਹੀਂ ਅਸੀਂ ਕਰਵਾਵਾਂਗੇ ਜੀ ਤੁਹਾਡਾ ਵੀ ਕੰਮ ਹਾਂਜੀ ਕੋਈ ਗੱਲ ਨਹੀਂ ਜੀ ਤੁਸੀਂ ਟੈਨਸ਼ਨ ਨਾ ਲਓ ਇਹ ਸਾਡੀ ਜ਼ਿੰਮੇਵਾਰੀ ਆ ਜੀ ਹਾਂਜੀ ਓਕੇ ਜੀ ਥੈਂਕ ਯੂ